ਪੰਦਰ੍ਹਾਂ ਅਗਸਤ ਉੱਨ੍ਹੀ ਸੌ ਸੰਤਾਲੀ ਛੱਬੀ ਜਨਵਰੀ ਉੱਨ੍ਹੀ ਸੌ ਪੰਜਾਹ ਪੰਜ ਮਾਰਚ ਉੱਨ੍ਹੀ ਸੌ ਛਿਆਨਵੇਂ ਪੰਜ ਫਰਵਰੀ ਦੋ ਹਜ਼ਾਰ ਇੱਕੀ ਸੱਤ ਨਵੰਬਰ ਦੋ ਹਜ਼ਾਰ ਬਾਈ